ਤੁਸੀਂ ਬੈਂਕ ਜਾ ਕੇ ਚੈੱਕ ਜਾਂ ਵਾਊਚਰ ਭਰ ਕੇ ਪੈਸੇ ਕਢਵਾ ਸਕਦੇ ਹੋ ਤੁਹਾਨੂੰ ਬਸ ਆਪਣਾ ਖਾਤਾ ਨੰਬਰ ਪਤਾ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਤੁਸੀਂ ਆਪਣੇ ਏ ਟੀ ਐਮ ਰਾਹੀਂ ਵੀ ਪੈਸੇ ਕਢਵਾ ਸਕਦੇ ਹੋ ਤੁਸੀਂ ਆਧਾਰ ਕਾਰਡ ਬੇਸ ਬੈਂਕਿੰਗ ਸਿਸਟਮ ਰਾਹੀਂ ਵੀ ਪੈਸੇ ਕਢਵਾ ਸਕਦੇ ਹੋ